ਪੰਜਾਬੀ ਲੋਕ ਜਿਹੜੇ ਹੁੰਦੇ ਹਨ ਉਹ ਦੂਜਿਆਂ ਦੀ ਬਹੁਤ ਹੀ ਮਦਦ ਕਰਨ ਵਿੱਚ ਅੱਗੇ ਹੁੰਦੇ ਹਨ ਅਤੇ ਜਿਵੇਂ ਕੀ ਪੰਜਾਬ ਦੇ ਵਿੱਚ ਕਾਫ਼ੀ ਟੂਰਿਸਟ ਆਉਂਦੇ ਜਿੱਦਾਂ ਮਹਾਰਾਸ਼ਟਰ ਤੋਂ ਆ ਗਏ ਕਰਨਾਟਕਾ ਤੋਂ ਆ ਗਏ ਕੇਰਲਾ ਤੋਂ ਆ ਗਏ ਜੋ ਜਦੋਂ ਉਹ ਹਰਿਮੰਦਰ ਸਾਹਿਬ ਵਗੈਰਾ ਦੇ ਦਰਸ਼ਨ ਕਰਨ ਆਉਂਦੇ ਆ ਜਾਂ ਵਾਹਗਾ ਬਾਰਡਰ ਦੇਖਣ ਆਉਂਦੇ ਆ ਪੰਜਾਬ ਦੇ ਵਿੱਚ ਆਉਂਦੇ ਹੈ ਅਤੇ ਉਹਨਾਂ ਨੂੰ ਪੰਜਾਬੀ ਸਮਝ ਨਹੀਂ ਆਉਂਦੀ ਉਹ ਆਪਣੀ ਹੀ ਭਾਸ਼ਾ ਬੋਲਦੇ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਉਹ ਬੰਗਾਲੀ ਵਗੈਰਾ ਨਹੀਂ ਆਂ ਪੰਜਾਬੀ ਦੇ ਵਿੱਚ ਬੋਲਦੇ ਹਨ ਅਤੇ ਉਹਨਾਂ ਨੂੰ ਜਿਹੜੇ ਮਹਾਰਾਸ਼ਟਰ ਹੁੰਦੇ ਉਹਨਾਂ ਨੂੰ ਪੰਜਾਬੀ ਦੇ ਵਿੱਚ ਸਮਝ ਨਹੀਂ ਆਉਂਦੀ ਇਸ ਕਰਕੇ ਜਿਹੜੇ ਪੰਜਾਬੀ ਲੋਕ ਆ ਉਹ ਹਿੰਦੀ ਦੀ ਵਰਤੋਂ ਕਰਦੇ ਹਾਂ ਤਾਂ ਕਿ ਪੰਜ ਹਿੰਦੀ ਸਾਰਿਆਂ ਨੂੰ ਹੀ ਆਉਂਦੀ ਹੈ ਇਸ ਕਰਕੇ ਉਹ ਹਿੰਦੀ ਦੀ ਵਰਤੋਂ ਕਰਦੇ ਅਤੇ ਤਾਂ ਕਿ ਮਹਾਰਾਸ਼ਟਰ ਤੋਂ ਜਿਹੜੇ ਟੂਰਿਸਟ ਆਏ ਹੋਏ ਹੈ ਉਹਨਾਂ ਨੂੰ ਸਾਡੀ ਗੱਲਬਾਤ ਸਮਝ ਆ ਜਾਵੇ ਕਿ ਅਸੀਂ ਕੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹੈ ਇਸ ਕਰਕੇ ਪੰਜਾਬੀ ਲੋਕ ਜਿਹੜੇ ਹੈ ਆਪਣੀ ਗੱਲਬਾਤ ਹਿੰਦੀ ਦੇ ਵਿੱਚ ਕਰ ਸਕਦੇ ਹਨ ਪਰ ਪੰਜਾਬੀ ਜਿਹੜੀ ਹੈ ਆਪਣੀ ਸਾਡੀ ਇੱਕ ਮਾਤਰ ਭਾਸ਼ਾ ਹੈ ਇਸ ਭਾਸ਼ਾ ਦੀ ਵਰਤੋਂ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਕਰਨੀ ਚਾਹੀਦੀ ਹੈ ਜਿਵੇਂ ਕਿ ਅੱਜ ਕੱਲ੍ਹ ਤਾਂ ਵਧੀਆ ਸਕੂਲ ਖੁੱਲ੍ਹ ਗਏ ਹਨ ਉਹਦੇ ਵਿੱਚ ਹਿੰਦੀ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ ਅਤੇ ਜਿਹੜੇ ਇਹ ਸਕੂਲਾਂ ਦੇ ਵਿੱਚ ਪੜ੍ਹੇ ਹੋਏ ਆ ਉਹਨਾਂ ਨੂੰ ਪੰਜਾਬੀ ਜਿਹੜੀ ਹੈ ਉਹ ਬਹੁਤ ਹੀ ਜ਼ਿਆਦਾ ਘੱਟ ਆਉਂਦੀ ਹੈ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਪੰਜਾਬੀ ਜਿਹੜੀ ਸਾਡੀ ਮਾਤ ਭਾਸ਼ਾ ਹੈਗੀ ਹੈ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਅਸੀਂ ਗੱਲਬਾਤ ਕਰਨ ਦੇ ਤਰੀਕੇ ਵਿੱਚ ਲਾਇਆ ਜਾ ਸ ਲਾ ਲਿਆਇਆ ਜਾਵੇ ਸਾਡੀ ਜਿਹੜੀ ਪੰਜਾਬੀ ਦੀ ਭਾਸ਼ਾ ਹੈ ਉਹ ਜਿਹੜੇ ਹਿੰਦੀ ਬੋਲਣ ਵਾਲੇ ਸਕੂਲ ਹੈ ਉਹਨਾਂ ਨੂੰ ਵੀ ਅਸੀਂ ਪੰਜਾਬੀ ਦੇ ਵਿੱਚ ਨਹੀਂ ਸਮਝਾ ਸਕਦੇ ਇਸ ਕਰਕੇ ਘਰਾਂ ਦੇ ਵਿੱਚ ਵੀ ਥੋੜ੍ਹਾ ਬਹੁਤ ਹਿੰਦੀ ਬੋਲਣ ਬੋਲਣਾ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਇਹ ਗਲਤ ਹੈ ਜਿਹੜੇ ਪੰਜਾਬੀ ਲੋਕ ਆ ਉਹਨਾਂ ਨੂੰ ਆਪਣੀ ਪੰਜਾਬੀ ਭਾਸ਼ਾ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਠੀਕ ਹੈ ਸਕੂਲ ਤੱਕ ਤਾਂ ਪੰਜਾ ਹਿੰਦੀ ਭਾਸ਼ਾ ਠੀਕ ਹੈ ਪਰ ਘਰ ਦੇ ਵਿੱਚ ਪੰਜਾਬੀ ਲੋਕ ਜਿਹੜੀ ਹੈ ਉਹ ਪੰਜਾਬੀ ਭਾਸ਼ਾ ਦੀ ਹੀ ਵਰਤੋਂ ਕਰਨ